ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਸੰਗੀਤ ਬੋਲ ਰਿਹੇ ਜੀ ਮੈਮ ਮੈਂ ਨਾ ਆਪਣੇ ਐਪ ਰਾਹੀਂ ਦੇਖ ਰਿਹਾ ਸੀ ਅਤੇ ਉਹਦੇ ਵਿੱਚ ਨਾ ਮੈਂ ਥੋਤੋ ਇਹ ਪਤਾ ਕਰਨਾ ਚਾਹੁੰਦਾ ਜੀ ਮੇਰੇ ਐਪ 'ਚ ਇੱਕ ਤਾਂ ਪ੍ਰੋਬਲਮ ਆ ਰਹੀ ਹੈ ਮੈਂ ਇਹ ਪਤਾ ਕਰਨਾ ਚਾਹੁੰਦਾ ਵੀ ਤੁਹਾਡੇ ਕੋਲ ਮੇਰੇ ਐਪ 'ਚ ਕਿੰਨੇ ਕੂਪਨ ਸ਼ੋਅ ਹੋ ਰਹੇ ਜੀ ਅੱਛਾ ਚਾਰ ਕੂਪਨ ਸ਼ੋਅ ਹੋ ਰਹੇ ਹੈ ਤਾਂ ਮੈਮ ਉਹ ਕਿੰਨੇ ਕਿੰਨੇ ਵਾਲੇ ਕੂਪਨ ਹੈ ਜੀ ਪੰਜਾਹ ਪੰਜਾਹ ਵਾਲੇ ਚਾਰ ਅੱਛਾ ਜੀ ਅਤੇ ਜੇਕਰ ਮੈਮ ਇਹਦੇ ਨਾਲ ਮੈਂ ਦੋ ਦੋ ਸੌ ਵਾਲੇ ਦੋ ਪੀਜ਼ੇ ਔਰਡਰ ਕਰਦਾ ਅਤੇ ਉਹਦੇ ਨਾਲ ਮੈਨੂੰ ਐਕਸਟਰਾ ਪੈਮੈਂਟ ਕਿੰਨੀ ਦੇਣੀ ਪਵੇਗੀ ਅੱਛਾ ਦੋ ਸੌ ਐਕਸਟਰਾ ਦੇਣਾ ਪਵੇਗਾ ਮਤਲਬ ਜੀ ਪੰਜਾਹ ਪੰਜਾਹ ਵਾਲੇ ਕੂਪਨਾਂ ਦਾ ਇੱਕ ਪੀਜ਼ਾ ਤਾਂ ਮੇਰਾ ਫ੍ਰੀ ਹੋ ਜਾਵੇਗਾ ਦੋ ਦੋ ਸੌ ਵਾਲੇ ਦੋ ਹੋ ਗਏ ਤਾਂ ਮੈ ਸਿਰਫ਼ ਇੱਕ ਪੀਜ਼ੇ ਦੇ ਹੀ ਪੈਸੇ ਦੇਣੇ ਹੈ ਜੀ ਮੈਂ ਅੱਛਾ ਜੀ ਅਤੇ ਤੁਸੀਂ ਇੱਦਾਂ ਕਰੋ ਮੇਰੇ ਨਾ ਦੋ ਪੀਜ਼ੇ ਔਰਡਰ ਕਰ ਦਿਉ ਅਤੇ ਮੇਰੇ ਐਡਰੈਸ 'ਤੇ ਭੇਜ ਦਿਓ ਜੀ ਬਟ ਔਕੇ ਜੀ ਥੈਂਕ ਯੂ